ਬਿਮਾਰੀਆਂ ਤੋ ਬਚਣ ਅਤੇ ਸਿਹਤਮੰਦ ਰਹਿਣ ਲਈ ਮੈਂ ਬਹੁਤ ਕੁਛ ਕਰਦਾ ਹਾਂ ਜਿਵੇਂ ਕਿ ਸਵੇਰ ਨੂੰ ਉੱਠਦੇ ਸਾਰ ਮੈਂ ਪਹਿਲਾਂ ਤਾਂ ਸੈਰ ਸਪਾਟੇ ਲਈ ਜਾਂਦਾ ਹਾਂ ਅਤੇ ਉੱਥੇ ਜਾ ਕੇ ਮੈਂ ਗਰਾਂਊ਼ਡ ਦੇ ਤਿੰਨ ਚਾਰ ਚੱਕਰ ਲਗਾਉਂਦਾ ਹਾਂ ਉਸ ਤੋਂ ਬਾਅਦ ਮੈਂ ਤਿੰਨ ਚਾਰ ਤਰ੍ਹਾਂ ਦੀਆਂ ਐਕਸਰਸਾਇਜ਼ ਜਿਵੇਂ ਕਿ ਯੋਗਾ ਕਰਦਾ ਹਾਂ ਉਹ ਮੈਨੂੰ ਬਹੁਤ ਹੀ ਤੰਦਰੁਸਤ ਰੱਖਦੀਆਂ ਹਨ ਅਤੇ ਆ ਕੇ ਮੈਂ ਘਰ ਦੋ ਤਿੰਨ ਗਲਾਸ ਪਾਣੀ ਦੇ ਪੀਂਦਾ ਹਾਂ ਤਾਂ ਕਿ ਮੈਂ ਆਪਣੇ ਆਪ ਨੂੰ ਫਰੈਸ਼ ਫੀਲ ਕਰ ਸਕਾਂ ਅਤੇ ਉਸ ਤੋਂ ਬਾਅਦ ਮੈਂ ਦਿਨ ਵਿੱਚ ਦੋ ਗਲਾਸ ਜੂਸ ਦੇ ਵੀ ਪੀਂਦਾ ਹਾਂ ਤਾਂ ਕਿ ਮੈਂ ਤੰਦਰੁਸਤ ਰਹਿ ਸਕਾਂ ਸ਼ਾਮ ਨੂੰ ਵੀ ਮੈਂ ਦੋ ਤਿੰਨ ਪ੍ਰਕਾਰ ਦੇ ਫਰੂਟ ਖਾਂਦਾ ਹਾਂ ਤਾਂ ਕਿ ਮੇਰੀ ਸਿਹਤ ਸਿਹਤਮੰਦ ਰਹੇ ਅਤੇ ਮੈਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕਾਂ